ਸਤਿ ਸ਼੍ਰੀ ਅਕਾਲ ਸਰ ਮੈਂ ਮਾਨਵ ਪਠਾਨੀਆ ਪਠਾਨਕੋਟ ਤੋਂ ਬੋਲ ਰਿਹਾ ਹਾਂ ਸਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਆਪ ਜੀ ਦੀ ਐਕਸ ਵਾਏ ਜੈੱਡ ਏਜੇਂਸੀ ਤੋਂ ਇੱਕ ਕੈਬ ਬੁੱਕ ਕਰਵਾਈ ਸੀ ਮੈਂ ਕੈਬ ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਲਈ ਕੈਬ ਦੀ ਬੁਕਿੰਗ ਕਰਵਾਈ ਸੀ ਮੇਰਾ ਕੈਬ ਬੁੱਕ ਕਰਵਾਉਣ ਦੀ ਵਜ੍ਹਾ ਇਹ ਸੀ ਕਿ ਮੇਰਾ ਅੰਮ੍ਰਿਤਸਰ ਵਿਖੇ ਪੰਜਾਬ ਪੁਲਿਸ ਦਾ ਪੇਪਰ ਸੀ

ਮੈਨੂੰ ਦੁੱਖ ਮਨ ਹੋ ਕੇ ਇਹ ਕਹਿਣਾ ਪੈ ਰਿਹਾ ਹੈ ਕਿ ਜੋ ਕਿ ਮੈਂ ਕੈਬ ਕੱਲ੍ਹ ਬੁੱਕ ਕਰਵਾਈ ਸੀ ਉਸ ਦੀ ਰਜਿਸਟ੍ਰੇਸ਼ਨ ਮੈਂ ਰੱਦ ਕਰਨਾ ਚਾਹੁੰਦਾ ਹਾਂ ਕਿਉਂਕਿ ਪੰਜਾਬ ਪੁਲਿਸ ਦਾ ਪੇਪਰ ਪੋਸਟਪੋਨ ਹੋ ਗਿਆ ਹੈ ਜਿਸ ਦਾ ਕਾਰਣ ਕਿਸਾਨਾਂ ਦੀ ਹੜਤਾਲ ਹੈ ਆਪ ਜੀ ਦੀ ਰਜਿਸਟ੍ਰੇਸ਼ਨ ਲਈ ਅੱਠ ਹਜ਼ਾਰ ਪੇਮੈਂਟ ਸੀ ਜਿਸ ਵਿੱਚੋਂ ਮੈਂ ਆਪ ਜੀ ਨੂੰ ਸਾਢੇ ਤਿੰਨ ਹਜ਼ਾਰ ਐਡਵਾਂਸ ਪੇਮੈਂਟ ਕੀਤੀ ਸੀ ਮੈਂ ਆਪ ਜੀ ਕੋ ਮੰਗ ਕਰਦਾ ਹਾਂ ਕਿ ਆਪ ਮੇਰੀ ਐਡਵਾਂਸ ਪੇਮੈਂਟ ਜੋ ਕਿ ਸਾਢੇ ਤਿੰਨ ਹਜ਼ਾਰ ਮੈਂ ਤੁਹਾਨੂੰ ਦਿੱਤੀ ਸੀ ਉਹ ਮੈਨੂੰ ਰਿਫੰਡ ਕੀਤੇ ਜਾਣ ਮੈਂ ਆਪ ਜੀ ਨੂੰ ਐਡਵਾਂਸ ਪੇਮੈਂਟ ਸਾਢੇ ਤਿੰਨ ਹਜ਼ਾਰ ਪੇਟੀਐੱਮ ਦੁਆਰਾ ਕੀਤੇ ਸੀ ਇਸ ਲੀਏ ਮੇਰੀ ਆਪ ਜੀ ਅੱਗੇ ਇਹ ਬੇਨਤੀ ਹੈ ਕੀ ਆਪ ਮੈਨੂੰ ਸਾਢੇ ਤਿੰਨ ਹਜ਼ਾਰ ਜੋ ਕੀ ਮੇਰੀ ਐਡਵਾਂਸ ਪੇਮੈਂਟ ਸੀ ਉਹ ਮੈਨੂੰ ਪੇਟੀਐੱਮ ਦੁਆਰਾ ਹੀ ਰਿਫੰਡ ਕੀਤੇ ਜਾਣ ਕਿਉਂਕਿ ਪੇਟੀਐੱਮ ਦਾ ਆਪਕੋ ਮੇਰਾ ਨੰਬਰ ਹੋਗਾ ਧੰਨਵਾਦ